ਖੇਤੀਬਾੜੀ ਦੇ ਨਾਲ ਅਨੇਕਾਂ ਹੀ ਇਹੋ ਜਿਹੇ ਧੰਦੇ ਹਨ ਜੋ ਕਿਸਾਨ ਆਪਣੀ ਦਿਲਚਸਪੀ ਦੇ ਅਨੁਸਾਰ ਕਰ ਸਕਦੇ ਹਨ ਜਿਨ੍ਹਾਂ ਵਿੱਚ ਪਸ਼ੂ ਪਾਲਣ ਇੱਕ ਅਜਿਹਾ ਧੰਦਾ ਹੈ ਜਿਸ ਦੇ ਵਿੱਚ ਉਹ ਖੇਤੀ ਦੇ ਨਾਲ ਵੀ ਅਗੈਂਸਟ ਰਹਿੰਦੇ ਨੇ ਅਤੇ ਉਹ ਪਸ਼ੂ ਪਾਲਣ ਦੇ ਨਾਲ ਆਪਣੀ ਆਮਦਨ ਦੇ ਵਿੱਚ ਵੀ ਵਾਧਾ ਕਰ ਸਕਦੇ ਨੇ ਇਸ ਤੋਂ ਇਲਾਵਾ ਉਹ ਮੱਛੀ ਪਾਲਣ ਕਰ ਸਕਦੇ ਨੇ ਪੋਲਟਰੀ ਫਾਰਮਿੰਗ ਕਰ ਸਕਦੇ ਨੇ ਇਹਦੇ ਨਾਲ ਉਹਨਾਂ ਦੀ ਆਮਦਨ ਦੁੱਗਣੀ ਤਿਗਣੀ ਹੋ ਜਾਂਦੀ ਹੈ ਅਤੇ ਉਹਨਾਂ ਦਾ ਕੰਮ ਕਰਨ ਦੇ ਵਿੱਚ ਦਿਲਚਸਪੀ ਵੀ ਵੱਧਦੀ ਜਾਂਦੀ ਹੈ ਕਿਉਂਕਿ ਇੱਕ ਕੰਮ ਕਰਨ ਦੀ ਬਜਾਏ ਜਦੋਂ ਇਨਸਾਨ ਦੋ ਤਿੰਨ ਕੰਮਾਂ ਦੇ ਵਿੱਚ ਬੱ ਬੱਝ ਜਾਂਦਾ ਤਾਂ ਉਹਨੂੰ ਚੰਗਾ ਲੱਗਦਾ ਕਿ ਮੈਂ ਹੋਰ ਕੰਮ ਕਰਾਂ ਜਿਵੇਂ ਉਹਨਾਂ ਦੀਆਂ ਔਰਤਾਂ ਘਰ ਦੇ ਵਿੱਚ ਰਹਿੰਦੀਆਂ ਨੇ ਘਰ ਦੇ ਕੰਮ ਕਰਨ ਦੇ ਨਾਲ ਨਾਲ ਉਹ ਜਿਵੇਂ ਅਚਾਰ ਬਣਾਉਣਾ ਮੁਰੱਬੇ ਬਣਾਉਣਾ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਸੇਲ ਕਰ ਸਕਦੀਆਂ ਨੇ ਇੱਕ ਤਾਂ ਘਰ ਵਿੱਚ ਰਹਿੰਦੀਆਂ ਔਰਤਾਂ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਅਤੇ ਦੂਸਰਾ ਉਨ੍ਹਾਂ ਨੂੰ ਵੀ ਘਰ ਦੇ ਕੰਮਾਂ ਦੇ ਨਾਲ ਨਾਲ ਜਦੋਂ ਕੋਈ ਹੋਰ ਕੰਮ ਮਿਲੇਗਾ ਤਾਂ ਉਹਨਾਂ ਦੀ ਦਿਲਚਸਪੀ ਹੋਰ ਜ਼ਿਆਦਾ ਵਧੇਗੀ ਕੰਮ ਕਰਨ ਦੇ ਵਿੱਚ ਉਹ ਆਪਣੀ ਸ਼ਖਸੀਅਤ ਨੂੰ ਹੋਰ ਵਧੇਰੇ ਨਿਖਾਰ ਸਕਣਗੀਆਂ ਅਤੇ ਉਹ ਇੱਕ ਆਪਣੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਗੀਆਂ ਕਿ ਅਸੀਂ ਵੀ ਕੁਛ ਕਰਨ ਦੇ ਯੋਗ ਹਾਂ ਕਿਉਂਕਿ ਜਦੋਂ ਘਰ ਦੇ ਵਿੱਚ ਕੋਈ ਔਰਤ ਰਹਿੰਦੀ ਹੈ ਤਾਂ ਉਹ ਸਿਰਫ਼ ਘਰ ਦੇ ਕੰਮ ਕਰਦੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਵਿੱਚ ਇੰਨੀ ਯੋਗਤਾ ਨਹੀਂ ਕਿ ਅਸੀਂ ਹੋਰ ਵੀ ਕੰਮ ਕਰ ਸਕੀਏ ਜਦੋਂ ਉਹ ਇਹ ਨਾਲ ਨਾਲ ਕੰਮ ਕਰਨਗੀਆਂ ਕੋਈ ਅਚਾਰ ਵੇਚ ਦਿੱਤਾ ਬਣਾ ਕੇ ਜਾਂ ਕੋਈ ਖੇਤੀਬਾੜੀ ਦੇ ਵਿੱਚ ਜਿਹੜੇ ਵੀ ਉਹਨਾਂ ਦੇ ਫਲ ਫਰੂਟ ਜਾਂ ਸਬਜ਼ੀਆਂ ਹੋ ਰਹੀਆਂ ਨੇ ਉਹਨਾਂ ਤੋਂ ਕੋਈ ਵਧੀਆ ਪ੍ਰੋਡਕਟ ਬਣਾ ਕੇ ਸੇਲ ਕਰਦੀਆਂ ਨੇ ਤਾਂ ਉਹਨਾਂ ਨੂੰ ਇੱਕ ਲੱਗਦਾ ਵੀ ਅਸੀਂ ਵੀ ਇੱਕ ਬਿਜਨਸ ਖੜ੍ਹਾ ਕਰ ਸਕਦੀਆਂ ਤਾਂ ਇਸ ਦੇ ਨਾਲ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਦੇ ਨਾਲ ਨਾਲ ਆਮਦਨ ਦੇ ਸੋਰਸ ਹੋਣ ਦੇ ਕਰਕੇ ਉਹ ਇੱਕ ਵਧੀਆ ਸ਼ਖਸੀਅਤ ਦੇ ਰੂਪ ਵਿੱਚ ਸਮਾਜ ਦੇ ਸਾਹਮਣੇ ਆਉਣਗੀਆਂ ਅਤੇ ਜਦੋਂ ਕਿਸਾਨ ਨੂੰ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਤਾਂ ਉਹ ਸਿੱਧਾ ਆਪਣਾ ਜਿਹੜਾ ਪ੍ਰੋਡਕਟ ਹੈ ਉਹ ਖੁਦ ਸੇਲ ਕਰਨ ਆਪਣਾ ਬਿਜ਼ਨਸ ਆਪ ਗਰੋ ਕਰਨ ਕਿਸੇ ਹੋਰ ਨੂੰ ਵਿੱਚ ਵਿਚੋਲਾ ਪਾਉਣ ਦੀ ਜਗ੍ਹਾ ਜਾਂ ਫਿਰ ਉਹ ਇੱਕ ਪ੍ਰੋਸੈਸਿੰਗ ਯੂਨਿਟ ਲਗਾ ਸਕਦੇ ਨੇ ਜੇ ਕੋਈ ਕਿਸੇ ਦਾ ਕਿੰਨੂਆਂ ਦਾ ਬਾਗ ਹੈ ਤਾਂ ਉਹ ਉਹਨਾਂ ਦਾ ਜਿਹੜਾ ਜੂਸ ਹੈ ਖੁਦ ਆਪਣੀ ਜੂਸ ਵਾਲੀ ਫੈਕਟਰੀ ਲਗਾਉਣ ਜੂਸ ਬਣਾ ਕੇ ਵੇਚਣ ਤਾਂ ਉਹਨਾਂ ਨੂੰ ਦੁੱਗਣਾ ਤਿਗਣਾ ਮੁਨਾਫ਼ਾ ਹੋਵੇਗਾ ਜਿਸ ਨਾਲ ਉਹ ਬਹੁਤ ਸਾਰਾ ਆਪਣਾ ਜੀਵਨ ਪੱਧਰ ਉੱਚਾ ਕਰ ਸਕਦੇ ਨੇ ਮੈਂ ਤਾਂ ਇਹ ਹੀ ਕਹੂੰਗੀ ਕਿ ਕਿਸਾਨਾਂ ਨੂੰ ਜ਼ਰੂਰ ਖੇਤੀਬਾੜੀ ਦੇ ਨਾਲ ਇੱਕ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਨੇ ਜਿਹਦੇ ਨਾਲ ਉਹ ਆਪਣੇ ਆਮਦਨ ਦੇ ਵਿੱਚ ਦੇ ਵਿੱਚ ਵਾਧਾ ਕਰਨ ਅਤੇ ਆਪਣੇ ਕਾਰੋਬਾਰ ਨੂੰ ਹੋਰ ਉੱਤੇ ਤੱਕ ਲੈ ਕੇ ਜਾਣ